ਹੈਲੋ ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਤੁਸੀਂ ਸੁਣਾਓ ਤੁਸੀਂ ਕਿਵੇਂ ਹੋ ਹਾਂਜੀ ਹਾਂਜੀ ਵਧੀਆ ਚਲੀ ਜਾਂਦਾ ਹੁਣ ਤਾਂ ਗਰਮੀ ਦਾ ਸੀਜ਼ਨ ਆ ਗਿਆ ਹੁਣ ਤਾਂ ਨਵੀਆਂ ਸਬਜ਼ੀਆਂ ਲਾਵਾਂਗੇ ਅਤੇ ਬਸ ਹੁਣ ਤਾਂ ਉਹ ਹੀ ਬਸ ਜਿਹੜਾ ਆਪਣਾ ਸਰਦੀ ਗਰਮੀਆਂ 'ਚ ਚੱਲਦੀਆਂ ਸਰਦੀਆਂ ਵਾਲੀਆਂ ਤਾਂ ਹੁਣ ਖ਼ਤਮ ਹੀ ਗਈਆਂ ਗਰਮੀਆਂ 'ਚ ਜਿਵੇਂ ਆਪਾਂ ਤੋਰੀ ਲਾ ਲਈ ਦੀ ਆ ਭਿੰਡੀਆਂ ਲਾ ਲਈ ਦੀਆਂ ਹੈ ਨਾ ਕੱਦੂ ਲਾ ਲਏ ਦੇ ਆ ਆਹੀ ਸਬਜ਼ੀਆਂ ਹੈਗੀਆਂ ਹਾਂਜੀ ਹਾਂਜੀ ਕਿਵੇਂ ਹਾਂ ਹਾਂ ਮੰਡੀ ਮੰਡੀ 'ਚ ਮੰਡੀ 'ਚ ਫੜਾ ਆਉਂਦੇ ਜਿਵੇਂ ਭਿੰਡੀਆਂ ਵਗੈਰਾ ਜ਼ਿਆਦਾ ਲਾਈਆਂ ਹੋਈਆਂ ਆਪਾਂ ਖੇਤ 'ਚ ਅਤੇ ਉਹ ਮੰਡੀ ਵਗੈਰਾ ਦੇ ਆਉਂਦੇ ਹਾਂ ਸਵੇਰੇ ਸਵੇਰੇ ਉਧਰੋਂ ਫਿਰ ਅਗਾਂਹ ਐਸਪੋਰਟ ਹਾਂ ਉਹ ਸਬਜ਼ੀਆਂ ਫਿਰ ਤਾਂ ਕਰਕੇ ਮਹਿੰਗੀਆਂ ਵਾਹਲੀਆਂ ਹੈ ਨਾ ਇੱਕ ਆਪਾਂ ਬੀਜ ਦੀ ਕੁਆਲਿਟੀ ਬੀਜ ਵਧੀਆ ਕਿਸਮ ਦਾ ਲੈ ਕੇ ਆਇਓ ਤੁਸੀਂ ਕਿਵੇਂ ਲਾਉਣੀ ਆ ਸੀਗੀਆਂ ਹਾਂ ਹਾਂ ਹਮ ਅੱਛਾ ਅੱਛਾ ਹਾਂਜੀ ਇਹ ਤਾਂ ਹੈਗਾ ਬਸ ਉੱਥੇ ਤੁਸੀਂ ਜਾਇਓ ਬੀ ਬੀਜ ਭੰਡਾਰ ਵੱਲ ਜਾਇਓ ਉਥੋਂ ਉਹਨਾਂ ਨੂੰ ਕਿਹਾ ਕਿ ਸਾਨੂੰ ਵਧੀਆ ਦੇਵੇ ਐਕਸਪਾਇਰੀ ਡੇਟ ਚੈੱਕ ਕਰ ਲਿਓ ਨਵੇਂ ਹੋਣ ਬੀਜ ਪੁਰਾਣੇ ਜਿਹੇ ਨਾ ਹੋਣ ਅਤੇ ਬਸ ਭਿੰਡੀ ਦੇ ਲੈ ਆਓ ਤੋਰੀ ਦੇ ਲੈ ਆਓ ਅਤੇ ਉਹਦੇ ਕੱਦੂ ਦੇ ਲੈ ਆਓ ਅਤੇ ਆ ਤਾਂ ਚੀਜ਼ਾਂ ਹੈ ਨਾ ਬੱਚੇ ਖਾ ਹੀ ਲੈਂਦੇ ਆ ਗੁਆਰ ਦੀਆਂ ਫਲੀਆਂ ਹੋ ਗਈਆਂ ਉਹ ਬਹੁਤ ਦੇਸੀ ਦੇਸੀ ਗੁਆਰ ਦੀਆਂ ਫਲੀਆਂ ਲਿਆਇਓ ਅਤੇ ਇੱਕ ਜਿਹੜੀਆਂ ਨੋਰਮਲ ਹੁੰਦੀਆਂ ਗੁਆਰ ਦੀਆਂ ਫਲੀਆਂ ਉਹ ਲੈ ਆਇਓ ਹਾਂਜੀ ਹਾਂਜੀ ਹਾਂਜੀ ਚਲ ਪਉਂਗੀ ਹਾਂ ਹਾਂਜੀ ਬਸ ਇਹ ਹੀ ਸਬਜ਼ੀਆਂ ਬਸ ਉਸਕੀ ਖਾਦੀ ਵਗੈਰਾ ਪਾ ਦਿਓ ਉਸ ਨਾਈਟਰੋਜਨ ਵਗੈਰਾ ਪਾ ਦਿਓ ਅਤੇ ਬਸ ਸਹੀ ਆ ਕੋਈ ਨਹੀਂ ਕੱਲ੍ਹ ਆਪਾਂ ਮਿਲਦੇ ਹਾਂ ਮੈਂ ਤੁਹਾਨੂੰ ਦੱਸ ਦਊਂਗੀ ਹੂੰ ਹੁੰ ਹਾਂਜੀ ਹਾਂਜੀ ਆ ਜਿਓ ਕੱਲ੍ਹ ਆ ਜਿਓ ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ